ਹਾਂਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਇਸ ਨੂੰ ਕੋਈ ਚੰਗਾ ਕਦਮ ਨਹੀਂ ਸਮਝਦਾ ਕਿਸਾਨ ਦਾ ਕਿਸਾਨ ਜਿਹੜਾ ਉਹ ਬਹੁਤ ਇੱਕ ਮਿਹਨਤੀ ਮਿਹਨਤੀ ਜਿਹੜਾ ਹੈਗਾ ਉਹ ਉਹ ਬਛਿੰਦਾ ਹੁੰਦਾ ਆ ਸਮਾਜ ਦਾ ਅਤੇ ਸਮਾਜ ਨੂੰ ਅੰਨ ਪੈਦਾ ਕਰਕੇ ਦਿੰਦਾ ਚਾਹੇ ਕਿਸੇ ਵੀ ਤਰ੍ਹਾਂ ਦੇ ਹਾਲਾਤ ਬਣ ਜਾਣ ਖੁਦਕੁਸ਼ੀ ਨਹੀਂ ਕਰਨੀ ਚਾਹੀਦੀ ਜ਼ਿੰਦਗੀ ਸਾਨੂੰ ਕੁਦਰਤ ਨੇ ਬਖਸ਼ੀ ਹੈ ਅਤੇ ਉਹਨੂੰ ਹੀ ਸਾਡੀ ਜ਼ਿੰਦਗੀ ਜਿਹੜੀ ਉਹਦਾ ਅੰਤ ਕਰਨ ਦਾ ਸਾਡੇ ਤੋਂ ਵਾਪਸ ਲੈਣ ਦਾ ਹੱਕ ਹੈਗਾ ਸਾਨੂੰ ਕੋਈ ਹੱਕ ਨਹੀਂ ਉਹਨੂੰ ਖ਼ਤਮ ਕਰਨ ਦਾ ਚਲੋ ਖੈਰ ਦੂਸਰੀ ਗੱਲ ਇਹ ਹੈ ਕਿ ਕਿਸਾਨ ਜਿਹੜੇ ਹੈਗੇ ਨੇ ਉਹ ਜੇ ਆਰਥਿਕ ਪੱਖੋਂ ਗੱਲ ਕਰਨੀ ਹੋਵੇ ਤਾਂ ਖੇਤੀ ਦੇ ਵਿੱਚ ਲਾਗਤ ਵੱਧ ਗਈ ਅਤੇ ਖੇਤੀ ਉਤਪਾਦਾਂ ਦੇ ਜਿਹੜੇ ਰੇਟ ਨੇ ਮੁੱਲ ਨੇ ਜਿਹੜੇ ਉਹ ਮਾਰਕਿਟ ਦੇ ਵਿੱਚ ਬਹੁਤ ਜ਼ਿਆਦਾ ਘੱਟ ਗਏ ਹੈਗੇ ਹੈ ਤਾਂ ਮੈਂ ਦੱਸਣਾ ਮੈਂ ਕਹਿਣਾ ਚਾਹੁੰਦਾ ਕਿ ਸਰਕਾਰਾਂ ਨੂੰ ਜਿਹੜਾ ਹੈਗਾ ਉਹ ਖੇਤੀ ਉਤਪਾਦਾਂ ਦੇ ਜਿਹੜੇ ਰੇਟ ਨੇ ਉਹ ਘਟਾਉਣੇ ਚਾਹੀਦੇ ਹੈ ਖੇਤੀ ਉਤਪਾਦਾਂ ਦੇ ਰੇਟ ਵਧਾਉਣੇ ਚਾਹੀਦੇ ਹੈ ਅਤੇ ਖੇਤੀ ਤੋਂ 'ਤੇ ਜਿਹੜਾ ਲਾਗਤ ਮੁੱਲ ਆ ਉਹਨੂੰ ਘਟਾਉਣਾ ਚਾਹੀਦਾ ਹੈਗਾ ਸਵਾਮੀਨਾਥਨ ਰਿਪੋਰਟ ਜਿਹੜੀ ਹੈਗੀ ਹੈ ਉਹ ਬੜੇ ਲੰਬੇ ਸਮੇਂ ਤੋਂ ਦਰਜ ਹੋਈ ਸਬਮਿਟ ਹੋਈ ਹੋਈ ਹੈ ਕੇਂਦਰ ਸਰਕਾਰ ਕੋਲ ਉਹਨੂੰ ਲਾਗੂ ਕਰਨਾ ਚਾਹੀਦਾ ਔਰ ਕਿਸਾਨਾਂ ਨੂੰ ਵੀ ਜਿਹੜਾ ਹੈਗਾ ਆਪਣੇ ਖੇਤੀ ਦੇ ਢੰਗ ਤਰੀਕੇ ਫ਼ਸਲੀ ਚੱਕਰ ਅਪਣਾਉਂਦਿਆਂ ਹੋਇਆਂ ਆਪਣੇ ਫ਼ਸਲੀ ਉਤਪਾਦਾਂ ਨੂੰ ਪ੍ਰੋਸੈਸ ਕਰਕੇ ਸਟੋਰ ਕਰਕੇ ਆਪਣਾ ਮਾਰਕਰ ਰਜਿਸਟਰ ਕਰਵਾ ਕੇ ਮਾਰਕਿਟ ਦੇ ਵਿੱਚ ਵੇਚਣਾ ਚਾਹੀਦਾ ਜਿਹੜੀ ਹੁਣ ਖੇਤੀ ਜਿਹੜੀ ਹੈਗੀ ਸਾਨੂੰ ਬਦਲਵੇਂ ਤਰੀਕੇ ਦੇ ਨਾਲ ਸਮੇਂ ਦੇ ਹਾਣ ਦੇ ਹੋ ਕੇ ਕਰਨੀ ਚਾਹੀਦੀ ਹੈ ਤਾਂ ਹੀ ਅਸੀਂ ਖੇਤੀ ਦੇ ਵਿੱਚੋਂ ਚੰਗੇ ਪੈਸੇ ਕਮਾ ਸਕਾਂਗੇ ਅਤੇ ਖੁਦਕੁਸ਼ੀਆਂ ਤੋਂ ਬਚ ਸਕਦੇ ਹਾਂ ਥੈਂਕ ਯੂ